ਜੇਕਰ ਗੱਲ ਕੀਤੀ ਜਾਵੇ ਮਨ ਪਸੰਦ ਦੇ ਕਵੀ ਦੀ ਮੈਂ ਪੰਜਾਬੀ ਭਾਸ਼ਾ ਨੂੰ ਪੜ੍ਹਦਾ ਤਾਂ ਬਹੁਤ ਹਾਂ ਛੋਟੇ ਹੁੰਦਿਆਂ ਆਪਣੇ ਪੇਪਰਾਂ ਦੇ ਇਸ ਟਾਈਮ 'ਤੇ ਹੀ ਪੜ੍ਹਿਆ ਹੋਇਆ ਉਹਨਾਂ ਉਸ ਟਾਈਮ 'ਤੇ ਕਾਫ਼ੀ ਜ਼ਿਆਦਾ ਕਵੀਆਂ ਬਾਰੇ ਵੀ ਪੜ੍ਹਿਆ ਪਰ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਅੱਜ ਦੇ ਟਾਈਮ ਵਿੱਚ ਮੈਨੂੰ ਕੋਈ ਵੀ ਅਜਿਹਾ ਕਵੀ ਵਗੈਰਾ ਯਾਦ ਨਹੀਂ ਹੈ ਪਰ ਹਾਂ ਕਵੀਆਂ ਦੀਆਂ ਲੇਖਕਾਂ ਬਾਰੇ ਕਾਫ਼ੀ ਜ਼ਿਆਦਾ ਕੁਝ ਸੁਣਿਆ ਵੀ ਹੋਇਆ ਅਤੇ ਅੱਜ ਵੀ ਸੁਣਦਾ ਵੀ ਆਇਆ ਹਾਂ ਕਵੀ ਕਾਫ਼ੀ ਕੁਛ ਚੰਗੀਆਂ ਚੀਜ਼ਾਂ ਵੀ ਦੱਸ ਜਾਂਦੇ ਹਨ ਅਤੇ ਕਹਾਵਤਾਂ ਕਹਾਵਤਾਂ ਵਿੱਚ ਅਤੇ ਸ਼ਾਈਲ ਸ਼ੇਰੋ ਸ਼ਾਇਰੀ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਸਾਨੂੰ ਸਿਖਾ ਵੀ ਜਾਂਦੇ ਹਨ ਮੈਨੂੰ ਸਿੱਖਣ ਵੇ ਵਿੱਚ ਅਤੇ ਕਵੀਆਂ ਦੀਆਂ ਕਵਿਤਾਵਾਂ ਸੁਣਨ ਵਿੱਚ ਬਹੁਤ ਹੀ ਆਨੰਦ ਆਉਂਦਾ ਹੈ ਕਈ ਵਾਰ ਜਦ ਨੀਂਦਰ ਨਹੀਂ ਆਉਂਦੀ ਤਾਂ ਮੰਮੀ ਮੈਨੂੰ ਕਵਿਤਾਵਾਂ ਸੁਣਾ ਕੇ ਵੀ ਸੁਲਾ ਚੁੱਕੀ ਹੈ ਛੋਟੇ ਹੁੰਦਿਆਂ ਦੇ ਸੁਣਦਾ ਅਤੇ ਕਵਿਤਾਵਾਂ ਸੁਣ ਸੁਣ ਕੇ ਹੀ ਸੌਂਦਾ ਸੀਗਾ ਹਾਂ ਕਈ ਕਵਿਤਾਵਾਂ ਇਹੋ ਜਿਹੀ ਕਈ ਕਵਿਤਾਵਾਂ ਇਹੋ ਜਿਹੀਆਂ ਵੀ ਹਨ ਜਿਨ੍ਹਾਂ ਨੂੰ ਸੁਣ ਕੇ ਮਨ ਵੀ ਭਰ ਆਉਂਦਾ ਹੈ ਪਰ ਉਹਨਾਂ ਕਵਿਤਾਵਾਂ ਦੇ ਥਰੂ ਮੈਂ ਕਾਫ਼ੀ ਕੁਝ ਸਿੱਖਿਆ ਵੀ ਹਾਂ ਕਵਿਤਾਵਾਂ ਇੱਕ ਇਹੋ ਜਿਹੀ ਹੀ ਚੀਜ਼ ਹੈ ਚੀਜ਼ ਹੈ ਜੋ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਹੁੰਦਿਆਂ ਤੱਕ ਚਲਦੀ ਹੀ ਰਹਿੰਦੀ ਹੈ ਅਤੇ ਅ ਅਸਾਂ ਉਹਨਾਂ ਨੂੰ ਬੱਚਿਆਂ ਨੂੰ ਵੀ ਸੁਣਾਉਂਦੇ ਹਾਂ ਅਤੇ ਵੱਡਿਆਂ ਨੂੰ ਵੀ ਸੁਣਾਉਂਦੇ ਹਾਂ ਵੱਡੇ ਲੋਕ ਆਪਣੀਆਂ ਉਹ ਹੀ ਕਵਿਤਾਵਾਂ ਪੁਰਾਣੀਆਂ ਕਵਿਤਾਵਾਂ ਨੂੰ ਲੈ ਲੈ ਕੇ ਛੋਟੇ ਬੱਚਿਆਂ ਨੂੰ ਸੁਣਾ ਸੁਣਾ ਕੇ ਸੁਲਾ ਵੀ ਦਿੰਦੇ ਹਨ ਅਤੇ ਬੱਚੇ ਸੁੱਖ ਦੀ ਨੀਂਦਰ ਸੋ ਵੀ ਜਾਂਦੇ ਹਨ